ਹਾਂਜੀ ਜਿਵੇਂ ਕਿ ਤੁਸੀਂ ਪੁੱਛਿਆ ਮੈਂ ਸਿਮਰਨ ਗੁਰਦਾਸਪੁਰ ਤੋਂ ਗੱਲ ਕਰ ਰਹੀ ਹਾਂ ਜਿਵੇਂ ਕਿ ਤੁਸੀਂ ਪੁੱਛਿਆ ਕਿ ਟੈਕਨੋਲਜੀ ਸਾਡੇ ਦੁਆਰਾ ਦੇ ਤਰੀਕੇ ਨੂੰ ਕਿਵੇਂ ਬਦਲ ਰਹੀ ਹੈ ਜਿਵੇਂ ਫਲਾਈਟਸ ਹਾਂਜੀ ਫਲਾਈਟਸ ਦਾ ਬੜਾ ਸੁੱਖ ਹੋ ਚੁੱਕਾ ਹੈ ਅੱਜ ਕੱਲ੍ਹ ਜਿਵੇਂ ਕਿ ਪਹਿਲਾਂ ਲੋਕ ਦੂਰ ਦੂਰ ਜਾਣ ਵਾਸਤੇ ਟ੍ਰੇਨਾਂ 'ਚ ਸਫ਼ਰ ਕਰਦੇ ਸੀ ਗੱਡੀਆਂ 'ਚ ਸਫ਼ਰ ਕਰਦੇ ਸੀ ਅਤੇ ਸੋ ਅੱਜ ਕੱਲ੍ਹ ਫਲਾਈਟਸ ਹੋ ਗਈਆਂ ਨੇ ਜੋ ਕਿ ਮਿੰਟੋ ਮਿੰਟੀ ਇਨਸਾਨ ਨੂੰ ਇੱਥੋਂ ਉੱਥੇ ਪਹੁੰਚਾ ਦਿੰਦੀਆਂ ਨੇ ਥੋੜ੍ਹੇ ਸਮੇਂ ਦੇ ਵਿੱਚ ਜਿਸ ਕਰਕੇ ਸਮੇਂ ਦੀ ਬੱਚਤ ਬਹੁਤ ਹੋ ਰਹੀ ਹੈ ਅਤੇ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਨੇ ਇੰਟਰਨੈਟ ਦਾ ਵੀ ਬੜਾ ਸੁਖ ਹੈ ਜਿਹਦੇ ਨਾਲ ਅੱਜ ਕੱਲ੍ਹ ਸਭ ਕੁਛ ਆਨਲਾਈਨ ਹੋ ਗਿਆ ਆ ਅਤੇ ਘਰ ਬੈਠੇ ਹੀ ਸੁੱਖ ਸੁਵਿਧਾਵਾਂ ਸਭ ਮਿਲ ਰਹੀਆਂ ਨੇ ਅਤੇ ਰੋਬੋਟਸ ਜਿੱਦਾਂ ਜਾਪਾਨ ਵਿਚ ਟੇਨੋਲੋਜੀ ਚੱਲੀ ਹੈ ਰੋਬੋਟਸ ਕੰਮ ਕਰਦੇ ਨੇ ਤੇ ਉਹ ਵੀ ਵਧੀਆ ਗੱਲ ਆ ਇਨਸਾਨਾਂ ਦਾ ਕੰਮ ਘੱਟ ਗਿਆ ਹੈ ਉਹਨਾਂ ਨੂੰ ਵੀ ਬਹੁਤ ਬੈਨੀਫਿਟ ਆ ਟੈਕਨੋਲਜੀ ਦਿਨੋ ਦਿਨ ਵੱਧ ਰਹੀ ਹੈ ਜਿਸ ਨਾਲ ਲੋਕਾਂ ਦੇ ਕੰਮ ਆਸਾਨ ਹੋ ਰਹੇ ਨੇ ਸੁਖ ਸੁਵਿਧਾਵਾਂ ਮਿਲ ਰਹੀਆਂ ਨੇ ਜਿਹੜੇ ਕੰਮ ਕਰਨ ਨੂੰ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਸੀਗਾ ਅੱਜ ਕੱਲ੍ਹ ਉਹ ਮਿੰਟੋ ਮਿੰਟ ਹੀ ਸਾਰੇ ਕੰਮ ਹੋ ਜਾਂਦੇ ਨੇ ਸੋ ਵਧੀਆ ਆ ਲੋਕਾਂ ਦਾ ਸਮੇਂ ਬਚਦਾ ਆ ਗਲਤ ਤਾਂ ਕੁਛ ਹੈ ਨਹੀਂ ਇਹਦੇ ਵਿੱਚ ਵਧੀਆ ਹੀ ਆ